ਅੱਜ ਕੱਲ੍ਹ ਤਾਂ ਆਮ ਸਕੂਲਾਂ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਖੇਡਾਂ ਵਿੱਚ ਦੌੜਨ ਵਿੱਚ ਰੁੱਝੇ ਹੋਏ ਨੇ ਸਵੇਰੇ ਸਵੇਰੇ ਜਦੋਂ ਸਕੂਲਾਂ ਵਿੱਚ ਪੀ ਟੀ ਟਾਈਮ ਹੁੰਦਾ ਹੈ ਤਾਂ ਸਭ ਤੋਂ ਪਹਿਲੇ ਬੱਚਿਆਂ ਨੂੰ ਕੁਝ ਐਕਸਰਸਾਈਜ਼ ਕਰਾਈ ਜਾਂਦੀ ਹੈ ਇੱਕ ਚੱਕਰ ਲਗਵਾਇਆ ਜਾਂਦਾ ਅਤੇ ਬੱਚੇ ਕਾਫੀ ਹੱਦ ਵਿੱਚ ਰੁੱਝੇ ਹੋਏ ਨੇ ਦੇਖੋ ਸਾਰਾ ਦਿਨ ਹੁਣ ਸਾਡਾ ਤਾਂ ਰੁਟੀਨ ਹੀ ਇਸ ਤਰ੍ਹਾਂ ਦਾ ਹੋ ਗਿਆ ਕਿ ਸਾਰਾ ਦਿਨ ਬੈਠੇ ਰਹਿਣਾ ਫੋਨ ਲੈਪਟੋਪ ਚਲਾਉਂਦੇ ਰਹਿਣਾ ਅਤੇ ਦੌੜਨਾ ਵੀ ਜਾਂ ਤੁਰਨਾ ਵੀ ਸਿਹਤ ਲਈ ਬੜਾ ਫਾਇਦੇਮੰਦ ਹੈ ਅੱਜ ਕੱਲ੍ਹ ਤਾਂ ਚਲੋ ਇਹ ਵੀ ਵਧੀਆ ਹੈ ਕਿ ਫਿਜੀਕਲ ਐਜੂਕੇਸ਼ਨ ਦਾ ਸਬਜੈਕਟ ਵੀ ਹੈਗਾ ਜਿਹਦੇ ਵਿੱਚ ਦੌੜਨਾ ਖੇਡਣਾ ਸਭ ਕੁਝ ਸਕੂਲਾਂ ਵਿੱਚ ਹੀ ਕਰਾਇਆ ਜਾਂਦਾ ਛੋਟੇ ਬੱਚਿਆਂ ਨੂੰ ਸਿਹਤਮੰਦ ਰਹਿਣ ਵਿੱਚ ਦੌੜਨਾ ਬਹੁਤ ਮਦਦ ਕਰਦਾ ਛੋਟੇਪਨ ਤੋਂ ਹੀ ਅਗਰ ਬੱਚੇ ਨੂੰ ਚੱਲਣ ਫਿਰਨ ਦੌੜਨ ਦੀ ਆਦਤ ਹੋਏਗੀ ਤਾਂ ਵੱਡੇ ਹੋ ਕੇ ਉਹਨੂੰ ਮੁਸ਼ਕਿਲ ਨਹੀਂ ਆਏਗੀ ਕਿਉਂਕਿ ਦੇਖੋ ਅਗਰ ਬੱਚੇ ਦੇਖੋ ਖਾਂਦੇ ਪੀਂਦੇ ਨੇ ਸਭ ਕੁਛ ਕਰਦੇ ਨੇ ਅਗਰ ਬੈਠੇ ਹੀ ਰਹਿਣਗੇ ਚਲਣ ਫਿਰਨਗੇ ਹੀ ਨਹੀਂ ਤਾਂ ਉਹਨਾਂ ਦਾ ਵਜਨ ਵੀ ਬਹੁਤ ਜ਼ਿਆਦਾ ਵੱਧ ਜਾਏਗਾ ਅਤੇ ਉਹ ਵਜਨ ਵਧੇਗਾ ਅਤੇ ਵੱਡੇ ਹੋਣਗੇ ਜਿਵੇਂ ਜਿਵੇਂ ਅਤੇ ਉਅ ਦੇ ਹੋਰ ਬਿਮਾਰੀਆਂ ਦਾ ਵੀ ਕਈਆਂ ਦਾ ਤੁਹਾਨੂੰ ਪਤਾ ਵੱਧਦੇ ਵਜਨ ਨਾਲ ਕਈ ਤਰ੍ਹਾਂ ਦੀਆਂ ਇਨਸਾਨ ਨੂੰ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਇਸ ਕਰਕੇ ਛੋਟੇਪਨ ਤੋਂ ਹੀ ਅਗਰ ਬੱਚੇ ਨੂੰ ਚੱਲਣ ਦੌੜਨ ਦੀ ਆਦਤ ਹੋਏ ਤਾਂ ਉਹ ਵੱਡੇ ਹੋ ਕੇ ਵੀ ਉਹਨਾਂ ਦੀ ਰੂਟੀਨ ਦੇ ਵਿੱਚ ਬਣੀ ਰਹਿੰਦੀ ਹੈ ਅਤੇ ਆਦਮੀ ਹਮੇਸ਼ਾ ਸਿਹਤਮੰਦ ਰਹਿੰਦਾ